ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਰੇਖਾ ਗੁਰਦਾਸਪੁਰ ਤੋਂ ਹਾਂ ਮੇਰੇ ਸਟੀਕੀ ਬਾਰੇ ਜਿਸ ਤਰ੍ਹਾਂ ਕਿ ਮੈਨੂੰ ਸਲਾਈ ਮੈਨੂੰ ਬੁਣਾਈ ਦਾ ਬਹੁਤ ਸ਼ੌਂਕ ਔਰ ਮੈਨੂੰ ਬਹੁਤ ਸਵੈਟਰ ਬਣਾਉਂਦੀ ਮੈਂ ਬਾਜ਼ਾਰ ਦੇ ਵੀ ਬਹੁਤ ਬਣਾਉਂਦੀ ਹਾਂ ਮੇਰੀ ਇੱਕੋ ਇੱਛਾ ਹੈ ਕਿ ਮੇਰਾ ਕੰਮ ਜ਼ਿਆਦਾ ਤੋਂ ਜ਼ਿਆਦਾ ਵਧੇ ਇਸ ਕਰਕੇ ਮੈਂ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਬਾਜ਼ਾਰ 'ਚ ਪੇਸ਼ ਕਰਾ ਬਣਾ ਕੇ ਤਾਂ ਕਿ ਮੇਰੇ ਕੰਮ ਨੂੰ ਲੋਕ ਸਰਾਹਨਾ ਦੇਣ ਮੇਰਾ ਟੀਚਾ ਹੈ ਕਿ ਮੇਰਾ ਕੰਮ ਵੱਧ ਤੋਂ ਵੱਧ ਵਧੇ ਜਿਹਦੇ ਨਾਲ ਕਿ ਮੈਨੂੰ ਥੋੜ੍ਹੀ ਆਮਦਨ ਵੀ ਹੋ ਜਾਏ ਔਰ ਮੇਰਾ ਨਾਮ ਵੀ ਹੋ ਜਾਏ ਇਸ ਕਰਕੇ ਮੈਂ ਮੇਰੇ ਟੀਚੇ ਵੱਡੇ ਹੀ ਹੈ ਕਿ ਮੈਂ ਬਹੁਤ ਤਰੱਕੀ ਕਰਾਂ ਮੈਂ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਬਣਾਵਾਂ ਮੈਂ ਮੋਬਾਈਲ ਤੋਂ ਵੇਖ ਕੇ ਵੀ ਡਿਜ਼ਾਇਨ ਉਤਾਰ ਲੈਂਦੀ ਹਾਂ ਮੇਰੀ ਇੱਛਾ ਇਹ ਹੀ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਾਂ ਤਾਂ ਕਿ ਮੇਰੇ ਪ੍ਰਸ਼ੰਸਾ ਹੋਏ ਔਰ ਮੇਰੇ ਡਿਜ਼ਾਇਨ ਲੋਕ ਪਸੰਦ ਕਰਨ ਮੈਂ ਬਹੁਤ ਮਿਹਨਤ ਮਿਹਨਤ ਕਰਦੀ ਹਾਂ ਆਪਣਾ ਸਵੇਰ ਦਾ ਕੰਮਕਾਰ ਨਿਪਟਾ ਕੇ ਮੈਂ ਸਲਾਈ ਕਰਨ ਬਹਿ ਜਾਂਦੀ ਹਾਂ ਬਣਾਉਂਦੀ ਹਾਂ ਬੁਣਾਈਆਂ ਕਰ ਕਰਕੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਪਾਉਂਦੀ ਹਾਂ ਸਲਾਈਆਂ ਵੀ ਬਣਾ ਲੈਂਦੀ ਕਰੋਸ਼ੀਆ ਵੀ ਬਣਾ ਲੈਂਦੀ ਹਾਂ ਇਸ ਕਰਕੇ ਮੈਨੂੰ ਸਲਾਈ ਦਾ ਸ਼ੁਰੂ ਤੋਂ ਹੀ ਬੁਣਾਈ ਦਾ ਬਹੁਤ ਸ਼ੌਂਕ ਆ ਸਲਾਈ ਬੁਣਾਈ ਦਾ ਅਤੇ ਮੈਂ ਕੰਮ ਮੈਂ ਇਹ ਹੀ ਕਹਿੰਦੀ ਹਾਂ ਕਿ ਮੇਰਾ ਡਿਜ਼ਾਇਨ ਵੱਧ ਤੋਂ ਵੱਧ ਅਲੱਗ ਅਲੱਗ ਹੋਣ ਔਰ ਲੋਕ ਪਸੰਦ ਕਰਨ ਮੈਂ ਬਾਜ਼ਾਰ 'ਚ ਵੀ ਸਵੈਟਰ ਬਣਾ ਕੇ ਦੁਕਾਨਾਂ 'ਤੇ ਵੀ ਦਿੰਦੀ ਹਾਂ ਔਰ ਮੇਰਾ ਟੀਚਾ ਇਹ ਹੀ ਹੈ ਕਿ ਮੇਰਾ ਕੰਮ ਜ਼ਿਆਦਾ ਵੱਧ ਜਾਏ ਤਾਂ ਕਿ ਮੇਰਾ ਥੋੜ੍ਹੀ ਇਨਕਮ ਹੋ ਜਾਵੇ ਔਰ ਮੈਂ ਖੂਬ ਤਰੱਕੀ ਕਰਾ ਤਾਂ ਕਿ ਲੋਕ ਮੈਨੂੰ ਪਸੰਦ ਕਰਨ ਹਾਂਜੀ ਸਲਾਈ ਦਾ ਮੈਨੂੰ ਬਹੁਤ ਸ਼ੌਂਕ ਹੈ ਟੀਚੇ ਮੇਰੇ ਵੱਡੇ ਹੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਮੈਂ ਆਪਣਾ ਬਿਜਨਸ ਵਧਾਵਾਂ ਅੱਗੇ ਆਪਣੇ ਬੱਚਿਆਂ ਨੂੰ ਗਲੀ ਦੇ ਬੱਚਿਆਂ ਨੂੰ ਕੁੜੀਆਂ ਨੂੰ ਵੀ ਮੈਂ ਬੁਣਾਈ ਸਿਖਾਉਂਦੀ ਹਾਂ ਤਾਂ ਕਿ ਅੱਗੇ ਤੋਂ ਬੱਚਿਆਂ ਦੇ ਭਾਤ ਖੁੱਲ੍ਹਣ ਕਿਉਂਕਿ ਅੱਜ ਕੱਲ੍ਹ ਬੱਚੇ ਕੰਮ ਨੂੰ ਕਰਕੇ ਖੁਸ਼ ਨਹੀਂ ਇਸ ਕਰਕੇ ਜਿਹੜੇ ਬੱਚੇ ਇੱਛੁਕ ਉਹਨਾਂ ਨੂੰ ਮੈਂ ਸਿਖਾਉਂਦੀ ਵੀ ਹਾਂ ਹਾਂਜੀ ਬਹੁਤ ਜ਼ਿਆਦਾ ਮੈਂ ਮਿਹਨਤੀ ਹਾਂ ਔਰ ਮੈਂ ਹਾਰਡ ਵਰਕ ਬਹੁਤ ਕਰਦੀ ਹਾਂ ਸਾਰਾ ਦਿਨ ਕੰਮ ਕਰਕੇ ਆਪਣਾ ਕੰਮ ਘਰਾਂ ਦੇ ਨਿਪਟਾ ਕੇ ਅਤੇ ਮੈਂ ਆਪਣੀ ਬੁਣਾਈ 'ਤੇ ਬਹਿ ਜਾਂਦੀ ਹਾਂ ਔਰ ਸਲਾਈਆਂ ਫੜ੍ਹ ਕੇ ਬਹਿ ਜਾਂਦੀ ਹਾਂ ਹਾਂਜੀ